ਹੈਲੋ ਸਤਿ ਸ਼੍ਰੀ ਅਕਾਲ ਵਧੀਆ ਪ੍ਰੀਤੀ ਤੂੰ ਸੁਣਾ ਹੋਰ ਕਿਵੇਂ ਚਲਦਾ

ਵਧੀਆ ਚਲਦੀ ਪਈ ਆ ਬਸ ਕਾਲਜ 'ਚ ਕੋਰਸ ਵਧੀਆ ਮਿਲਿਆ ਹੋਇਆ ਉਹੀ ਕਰੀ ਜਾਂਦੇ ਹਾਂ ਹੁਣ ਮੈਂ ਬੀ ਐਮ ਐਲ ਟੀ ਕਰਦੀ ਪਈ ਹਾਂ ਮੈਡੀਕਲ ਕਾਲਜ 'ਚ ਵਧੀਆ

ਅੱਛਾ ਹਾਂ ਹਾਂ ਮਿਲ ਸਕਦੇ ਇੱਥੇ ਤੈਨੂੰ ਵਾਧੂ ਮੌਕੇ ਮਿਲਣਗੇ ਨੌਕਰੀ ਵਾਸਤੇ ਤੂੰ ਸਰਕਾਰੀ ਨੌਕਰੀ ਵਾਸਤੇ ਵੀ ਉਹ ਕਰ ਸਕਦੀ ਆਂ ਅਪਲਾਈ ਜਾਂ ਜੇ ਤੂੰ ਪ੍ਰਾਈਵੇਟ ਕਰੇਗੀ ਉਹਦੇ 'ਚ ਵੀ ਤੈਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਤੇਰਾ ਇੰਟਰਸਟ ਵੈਸੇ ਕਾਹਦੇ 'ਚ ਆ ਟੀਚਿੰਗ 'ਚ ਜਾਂ ਇੰਜੀਨੀਅਰਿੰਗ 'ਚ ਹਾਂ ਫਿਰ ਤਾਂ ਵਧੀਆ ਤੈਨੂੰ ਵਾਧੂ ਮੇ ਮੌਕੇ ਮਿਲ ਜਾਣਗੇ ਗਵਰਨਮੈਂਟ ਸਰਕਾਰੀ ਨੌਕਰੀਆਂ ਵੀ ਵਾਧੂ ਮਿਲ ਸਕਦੀਆਂ ਤੈਨੂੰ ਕਿਉਂਕਿ ਇੱਥੇ ਮਤਲਬ ਕਿ ਸਰਕਾਰੀ ਟੀਚਰਾਂ ਦੀ ਬਹੁਤ ਉਹ ਹੈਗੀ ਆ

ਅੱਛਾ ਹਾਂ ਫਿਰ ਮੈਥ 'ਚ ਵੀ ਤੂੰ ਕਰ ਸਕਦੀ ਕਿਉਂਕਿ ਇੱਥੇ ਮੈਥ ਦੇ ਟੀਚਰ ਵੀ ਬਹੁਤ ਘੱਟ ਆ ਇੱਕ ਸਕੂਲ ਸੀ ਮੇਰੀ ਜਾਣ ਪਹਿਚਾਣ ਹੈਗੇ ਉੱਥੋਂ ਦੇ ਪ੍ਰਿੰਸੀਪਲ ਨਾਲ ਵੀ ਸਟਾਫ ਨਾਲ ਵੀ ਹੈਗੀ ਆ ਉੱਥੋਂ ਤੂੰ ਅਪਲਾਈ ਕਰ ਸਕਦੀ ਆਂ ਭਰ ਸਕਦੀ ਆਂ ਫਾਰਮ ਵਗੈਰਾ ਉੱਥੇ ਤੈਨੂੰ ਸਰਕਾਰੀ ਨੌਕਰੀ ਮਿਲ ਜਾਏਗੀ ਟੀਚਿੰਗ ਵਾਸਤੇ ਹੋਰ ਜੇਕਰ ਤੂੰ ਹਾਂ ਹਾਂ ਵਾਧੂ ਇੱਥੇ ਤਾਂ ਸਟੂਡੈਂਟਸ ਵੀ ਮਤਲਬ ਜਿਹੜੇ ਵਿਦਿਆਰਥੀ ਹੈਗੇ ਆ ਪੜ੍ਹਨ ਜਾਂਦੇ ਆ ਉਹਨਾਂ ਨੂੰ ਵੀ ਮੈਥ ਦੇ ਟੀਚਰ ਦੀ ਬਹੁਤ ਲੋੜ ਪੈਂਦੀ ਆ ਤੂੰ ਜੇਕਰ ਟਿਊਸ਼ਨਾਂ ਵਗੈਰਾ ਵੀ ਕਰੇਗੀ ਤਾਂ ਵੀ ਤੈਨੂੰ ਬਹੁਤ ਫਾਇਦਾ ਹੋਊਗਾ ਲਾਭ ਹੋਊਗਾ ਬਹੁਤ ਤੂੰ ਮਤਲਬ ਕਿ ਵਧੀਆ ਕਮਾ ਸਕਦੀ ਆਂ ਫਾਈਨੈਂਸ਼ੀਅਲ ਵੀ

ਹੋਰ ਹਾਂ ਹੋਰ ਬਸ ਮੈਂ ਤੈਨੂੰ ਕਹਿ ਰਹੀ ਹਾਂ ਜਿਹੜਾ ਮੈਂ ਇੱਥੇ ਹੈਗਾ ਗਵਰਮੈਂਟ ਹਾਈ ਸਕੂਲ ਉੱਥੇ ਮੈਂ ਤੈਨੂੰ ਪਤਾ ਕਰ ਦਊਂਗੀ ਤੂੰ ਉੱਥੇ ਫਾਰਮ ਵਗੈਰਾ ਭਰ ਲਈ ਫੋਰਮ ਉੱਥੇ ਫਿਰ ਤੈਨੂੰ ਗਵਰਮੈਂਟ ਟੀਚਰ ਦੀ ਉਹ ਮਿਲ ਜਾਏਗੀ ਨੌਕਰੀ ਧੰਨਵਾਦ